ਮੇਰੇ ਦੋਸਤ ਸੁਰਜੀਤ ਨੇ ਹਾਕੀ ਖੇਡਣ ਦੀ ਸਿਖਲਾਈ ਲੈਣੀ ਹੈ ਉਸ ਨੂੰ ਬਚਪਨ ਤੋਂ ਹੀ ਖੇਡਣ ਵਿੱਚ ਰੁਚੀ ਰਹੀ ਹੈ ਸਕੂਲ ਵਿੱਚ ਵੀ ਉਹ ਬਹੁਤ ਵਧੀਆ ਹਾਕੀ ਖੇਡ ਦਾ ਰਿਹਾ ਹੈ ਅਸੀਂ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਬਲਕਾਰ ਕੋਲ ਗਏ ਉਹ ਵੀ ਖੇਡਾਂ ਵਿੱਚ ਹੈ ਉਹ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਹੈ ਉਸ ਨਾਲ ਅਸੀਂ ਸਲਾਹ ਕਰੀ ਉਹ ਜਿਸ ਅਕੈਡਮੀ ਵਿੱਚ ਸਿੱਖਦਾ ਰਿਹਾ ਹੈ ਉੱਥੇ ਜਾ ਕੇ ਅਸੀਂ ਉੱਥੇ ਕੋਚ ਨੂੰ ਮਿਲਾਂਗੇ ਅਤੇ ਨਾਲ ਹੀ ਸਿਖਲਾਈ ਸਹੂਲਤਾਂ ਵੀ ਪੁੱਛਾਂਗੇ ਕਿ ਅਕੈਡਮੀ ਵਿੱਚ ਸਿੱਖਿਆਰਥੀਆਂ ਨੂੰ ਖੇਡਣ ਲਈ ਸਾਰਾ ਸਮਾਨ ਉਪਲੱਬਧ ਕਰਵਾਇਆ ਜਾਵੇਗਾ ਜਾਂ ਨਹੀਂ ਅਤੇ ਅਕੈਡਮੀ ਵਿੱਚ ਰਹਿਣ ਦਾ ਇੰਤਜ਼ਾਮ ਕਿਹੋ ਜਿਹਾ ਹੈ ਉੱਥੇ ਰਹਿਣ ਲਈ ਵਿਦਿਆਰਥੀਆਂ ਲਈ ਸਾਰੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਜਾਂ ਨਹੀਂ